ਮੈਂ ਇੱਕ ਫਲਿੱਪਕਾਰਟ 'ਤੇ ਇੱਕ ਗੌਲਡਨ ਕਲਰ ਦਾ ਕੜਾ ਮੰਗਵਾਇਆ ਸੀ ਜੋ ਕਿ ਦੇਖਣ ਵਿੱਚ ਬਹੁਤ ਸੋਹਣਾ ਲੱਗ ਰਿਹਾ ਸੀ ਮੈਂ ਵਿਆਹ ਸ਼ਾਦੀ 'ਤੇ ਵੀ ਇੱਕ ਦੋ ਵਾਰ ਪਾਇਆ ਉਹ ਸੋਹਣਾ ਲੱਗ ਰਿਹਾ ਸੀ ਪਰ ਦੋ ਤਿੰਨ ਵਾਰ ਪਾਣੀ ਲੱਗਣ 'ਤੇ ਹੀ ਉਹ ਫਿੱਕਾ ਜਿਹਾ ਪੈ ਗਿਆ ਉਹ ਬਿਲਕੁਲ ਹੀ ਕਾਲਾ ਲੱਗ ਰਿਹਾ ਹੈ ਬਿਲਕੁਲ ਵੀ ਖਰਾਬ ਬਿਲਕੁਲ ਹੀ ਖਰਾਬ ਹੋ ਗਿਆ ਹੈ ਇਸ ਲਈ ਮੈਂ ਸਾਰਿਆਂ ਨੂੰ ਸਲਾਹ ਦੇਣਾ ਚਾਹਾਂਗੀ ਕਿ ਔਨਲਾਈਨ ਕੋਈ ਵੀ ਚੀਜ਼ ਨਾ ਮੰਗਵਾਈ ਜਾਵੇ ਸਿਰਫ਼ ਦੁਕਾਨ 'ਤੇ ਹੀ ਜਾ ਕੇ ਖਰੀਦੀ ਜਾਵੇ